ਪੌਦੇ ਉਗਾਉਣ ਵਾਸਤੇ ਅਸੀਂ ਘਰੇਲੂ ਮਿੱਟੀ ਇਸਤੇਮਾਲ ਕਰਦੇ ਹਾਂ ਅਤੇ ਨਹਿਰੀ ਮਿੱਟੀ ਜਿਹਨੂੰ ਕਿ ਭੱਲ ਵਾਲੀ ਮਿੱਟੀ ਕਿਹਾ ਜਾਂਦਾ ਹੈ ਉਸ ਨੂੰ ਵੀ ਇਸਤੇਮਾਲ ਕਰਦੇ ਹਾਂ ਘਰੇਲੂ ਪੌਦਿਆਂ ਲਈ ਘਰੇਲੂ ਰੂੜੀ ਜਿਹਨੂੰ ਕਿ ਆਪਾਂ ਔਰਗੈਨਿਕ ਕਹਿ ਸਕਦੇ ਹਾਂ ਅਤੇ ਜਾਂ ਫਿਰ ਸੁਪਰ ਖਾਦ ਯੂਰੀਆ ਖਾਦ ਜਾਂ ਫਿਰ ਪੌਦਿਆਂ ਵਾਸਤੇ ਇੱਕ ਸਪੈਸ਼ਲ ਬਣੀ ਬਣੀ ਜਿਹੜੀ ਆ ਖਾਦ ਮਾਰਕੀਟ ਤੋਂ ਮਿਲਦੀ ਹੈ ਜੋ ਕਿ ਅਸੀਂ ਪੌਦਿਆਂ ਨੂੰ ਪਾ ਸਕਦੇ ਹਾਂ ਪੌਦੇ ਸਾਡੀ ਜਮੀਨ ਜਿਹੜੀ ਹੈ ਪੈਦਾਵਾਰ ਆ ਜਿਹਦੇ ਵਿੱਚ ਅਸੀਂ ਖੇਤੀ ਕਰਦੇ ਹਾਂ ਉਹਦੇ ਵਿੱਚ ਹਰ ਤਰ੍ਹਾਂ ਦਾ ਪੌਦਾ ਜਿਹੜਾ ਵਾ ਉਗਾਇਆ ਜਾ ਸਕਦਾ ਹੈ ਕਿਉਂਕਿ ਸਾਡੇ ਪੰਜਾਬ ਦੀ ਮਿੱਟੀ ਲਗਭਗ ਸਾਰੀ ਉਪਜਾਊ ਹੈ ਅਤੇ ਉਪਜਾਊ ਮਿੱਟੀ ਦੇ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਦਾ ਪੌਦਾ ਜਿਹੜਾ ਉਗਾ ਸਕਦੇ ਹਾਂ